ਸਤਿ ਸ਼੍ਰੀ ਆਕਾਲ ਜੀ ਮੈਂ ਦਲਜੀਤ ਸਿੰਘ ਮੋਹਾਲੀ ਤੋਂ ਬੋਲ਼ ਰਿਹਾ ਹਾਂ ਮੈਂ ਕੁਝ ਮੈਂ ਕੁਝ ਦਿਨਾਂ ਪਹਿਲਾਂ ਤੁਹਾਡੇ ਇੰਸਟਾਗ੍ਰਾਮ ਪੇਜ ਤੋਂ ਇੱਕ ਕੈਮਰਾ ਬੁੱਕ ਕੀਤਾ ਸੀ ਉਹ ਕੈਮਰਾ ਮੈਨੂੰ ਬਹੁਤ ਚੰਗਾ ਲੱਗਿਆ ਉਹਦਾ ਕਲਰ ਬਹੁ ਉਹਦਾ ਕਲਰ ਬਲਿਊ ਸੀ ਜਿਸ ਨਾਲ ਜਿਹੜਾ ਕਲਰ ਮੈਨੂੰ ਬਹੁਤ ਪਸੰਦ ਹੈ ਮੈਂ ਉਹ ਕੈਮਰਾ ਤੁਸੀਂ ਬਹੁਤ ਪੈਕੇਜ ਬਹੁਤ ਚੰਗੇ ਤਰੀਕੇ ਨਾਲ਼ ਕੀਤਾ ਹੋਇਆ ਸੀ ਤੁਸੀਂ ਉਹਨੂੰ ਬਹੁਤ ਸੇਫ ਢੰਗ ਨਾਲ਼ ਪੈਕ ਕੀਤਾ ਹੋਇਆ ਸੀ ਮੈਨੂੰ ਤੁਹਾਡਾ ਇਹ ਕੈਮਰਾ ਬਹੁਤ ਵਧੀਆ ਲੱਗਿਆ ਤੁਹਾਡੇ ਪਅ ਕੈਮਰੇ ਦੀ ਕੁਆਲਟੀ ਫੋਟੋ ਵੀ ਬਹੁਤ ਚੰਗੀ ਹੈ ਮੈਂ ਪਿਛਲੇ ਮੈਂ ਕੁਝ ਸਮਾਂ ਪਹਿਲਾਂ ਸ਼ਿਮਲੇ ਗਿਆ ਸੀ ਉੱਥੇ ਮੈਂ ਕੁਝ ਫੋਟੋਆ ਖਿੱਚੀਆਂ ਸਨ ਉਹ ਫੋਟੋਆਂ ਦੀ ਕੁਆਲਟੀ ਬਹੁਤ ਹੀ ਵਧੀਆ ਹੈ ਮੈਨੂੰ ਤੁਹਾਡਾ ਕੈਮਰਾ ਬਹੁਤ ਹੀ ਵਧੀਆ ਲੱਗਾ ਤੁਸੀਂ ਮੈਨੂੰ ਦਸ ਪ੍ਰਸੈਂਟ ਡਿਸਕਾਊਂਟ ਨਾਲ਼ ਇਹ ਕੈਮਰਾ ਦਿੱਤਾ ਸੀ ਬਹੁਤ ਚੰਗੀ ਕੁਆਲਟੀ ਦਾ ਕੈਮਰਾ ਮੈਨੂੰ ਦਿੱਤਾ ਜਿਸ ਨਾਲ਼ ਮੈਨੂੰ ਮੇਰੇ ਰਿਸ਼ਤੇਦਾਰ ਅਤੇ ਮੇਰੇ ਦੋਸਤ ਮਿੱਤਰ ਕਹਿੰਦੇ ਹਨ ਕਿ ਮੈਂ ਅਸੀਂ ਵੀ ਇਹ ਕੈਮਰਾ ਤੁਹਾਡੇ ਕੋਲ਼ੋਂ ਲੈਣਾ ਚਾਹੁੰਦੇ ਹਾਂ ਇਸ ਕਰਕੇ ਮੈਂ ਤੁਹਾਨੂੰ ਕਹਿ ਇਸ ਕਰਕੇ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਤੁਹਾਡੇ ਇੰਸਟਾਗ੍ਰਾਮ ਪੇਜ 'ਤੇ ਜਾ ਕੇ ਇਹ ਕੈਮਰਾ ਤੁਸੀਂ ਲੈ ਸਕਦੇ ਹੋ ਧੰਨਵਾਦ